ਸਤਾਰ੍ਹਾਂ ਫਰਵਰੀ ਉੱਨੀ ਸੌ ਅਠਾਨਵੇਂ ਅਠਾਈ ਜਨਵਰੀ ਦੋ ਹਜ਼ਾਰ ਨੌ ਉਨੱਤੀ ਅਕਤੂਬਰ ਉੱਨੀ ਸੌ ਅਠਾਸੀ ਚੌਵੀ ਸਤੰਬਰ ਦੋ ਹਜ਼ਾਰ ਬਾਰ੍ਹਾਂ ਨੌ ਅਗਸਤ ਉੱਨੀ ਸੌ ਸਤਾਨਵੇਂ